ਫਰੀਦਕੋਟ ਜ਼ਿਲ੍ਹੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਅਤੇ ਕਈ ਇਤਿਹਾਸਿਕ ਸਥਾਨ ਹਨ ਜਿਵੇਂ ਕਈ ਮੰਦਰ ਕਿਲੇ ਅਜਾਇਬ ਘਰ ਅਤੇ ਹੋਰ ਕਈ ਇਹੋ ਜਿਹੀਆਂ ਮਹੱਤਵਪੂਰਨ ਕੁਦਰਤ ਨਾਲ ਰਿਲੇਟਡ ਵਿਸ਼ੇਸ਼ਤਾਵਾਂ ਹਾਂ ਇਹ ਸਭ ਸਾਡੇ ਲਈ ਬਹੁਤ ਹੀ ਖੁੱਲੇ ਹਨ ਅਤੇ ਸਾਨੂੰ ਲੋਕਾਂ ਨੂੰ ਇੱਥੇ ਜਾਣ ਦੀ ਪਰਮਿਸ਼ਨ ਹੈ ਜਿਵੇਂ ਬਾਬਾ ਫਰੀਦ ਟਿੱਲਾ ਬਾਬਾ ਫਰੀਦ ਜੀ ਫਰੀਦਕੋਟ ਵਿੱਚ ਹੈ ਇੱਥੇ ਤਿੰਨ ਦਿਨ ਮੇਲਾ ਲੱਗਦਾ ਹੈ ਲੋਕੀ ਵਿਹਲੇ ਸਮੇਂ ਵਿੱਚ ਵੀ ਇੱਥੇ ਜਾ ਸਕਦੇ ਹਨ ਇੱਥੇ ਲੰਗਰ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੈ ਇਸ ਤੋਂ ਇਲਾਵਾ ਮੰਦਰ ਵੀ ਹੈ ਫਰੀਦਕੋਟ ਵਿੱਚ ਪੰਚਵਟੀ ਮੰਦਰ ਇੱਥੇ ਗਊਆਂ ਨੂੰ ਲੋਕੀ ਦੂਰ ਦੂਰ ਤੋਂ ਪੱਠੇ ਪਾਉਂਦੇ ਹਨ ਆ ਕੇ ਅਤੇ ਕਹਿੰਦੇ ਹਨ ਕਿ ਜਿਹੜਾ ਗਊ ਨੂੰ ਦਊ ਪੱਠੇ ਪਾਉਣ ਸਮੇਂ ਉਹਦੇ ਸਿਰ 'ਤੇ ਹੱਥ ਰੱਖ ਦੇਵੇ ਤਾਂ ਉਹ ਜੋ ਵੀ ਆਪਦੀ ਜ਼ਿੰਦਗੀ ਦੇ ਵਿੱਚ ਜੋ ਮੰਗਣਾ ਚਾਹਵੇ ਉਹਦੀ ਉਹ ਇੱਛਾ ਪੂਰੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਇੱਥੇ ਰਾਜੇ ਦਾ ਇੱਕ ਮਹਿਲ ਵੀ ਬਣਿਆ ਹੋਇਆ ਜਿੱਥੇ ਲੋਕੀ ਅੰਦਰ ਜਾ ਕੇ ਲੋਕਾਂ ਨੂੰ ਉੱਥੋਂ ਕਈ ਤਰ੍ਹਾਂ ਦੀਆਂ ਇਤਿਹਾਸਿਕ ਪਿਕਚਰਾਂ ਤੋਂ ਬਹੁਤ ਸਾਰੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਸ ਤੋਂ ਇਲਾਵਾ ਲੋਕ ਹੋਰ ਕਈ ਗੁਰਦੁਆਰਿਆਂ ਵਿੱਚ ਵੀ ਜਾਂਦੇ ਹਨ ਇੱਥੇ ਹੋਰ ਕਈ ਰਾਜ ਮਹਿਲ ਵੀ ਹੈ ਇੱਥੇ ਇੱਕ ਜਿੱਥੇ ਲੋਕ ਉੱਥੇ ਕਬੂਤਰ ਚੋਗਾ ਵੀ ਪਾਉਂਦੇ ਹਨ ਔਰ ਬਾਬਾ ਫਰੀਦ ਜੀ ਦਾ ਅਤੇ ਬਾਬਾ ਫਰੀਦ ਜੀ ਦਾ ਮੰਨਦੇ ਅਤੇ ਗਾਂ ਵੀ ਇੱਕ ਕੋਟਕਪੂਰਾ ਰੋਡ ਉੱਤੇ ਦ ਬਾਬਾ ਫਰੀਦ ਜੀ ਦਾ ਟਿੱਲਾ ਹੈ